ਮੇਰੇ ਅਨੁਸਾਰ ਪਰਿਵਾਰ ਨਾਲ ਮਨੋਰੰਜਨ ਕਰਨਾ ਮੈਨੂੰ ਵੱਧ ਪਸੰਦ ਹੈ ਕਿਉਂਕਿ ਪਰਿਵਾਰ ਵਿੱਚ ਰਹਿ ਕੇ ਹੀ ਇਨਸਾਨ ਅਸ ਆਪਣੇ ਪੁਰਾਤਨ ਸੱਭਿਆਚਾਰ ਬਾਰੇ ਜਾਣੂ ਹੋ ਸਕਦਾ ਹੈ ਪਰਿਵਾਰ ਵਿੱਚ ਰਹਿ ਕੇ ਹੀ ਉਸ ਨੂੰ ਸਮਾਜ ਵਿੱਚ ਵਿਚਰਨ ਦੇ ਤੌਰ ਤਰੀਕਿਆਂ ਬਾਰੇ ਪਤਾ ਲੱਗਦਾ ਹੈ ਅਤੇ ਇੱਕ ਪਰਿਵਾਰ ਹੀ ਹੈ ਜੋ ਤੁਹਾਡੇ ਔਖੇ ਜਾਂ ਚੰਗੇ ਮਾੜੇ ਸਮੇਂ ਵਿੱਚ ਤੁਹਾਡੇ ਲਈ ਹਮੇਸ਼ਾਂ ਤੁਹਾਡੇ ਨਾਲ ਖੜ੍ਹਾ ਹੁੰਦਾ ਹੈ ਜਾਣੇ ਅਣਜਾਣੇ ਵਿੱਚ ਹੋਣ ਵਾਲੀਆਂ ਗਲਤੀਆਂ ਨੂੰ ਵੀ ਪਰਿਵਾਰ ਦੁਆਰਾ ਹੀ ਨਜ਼ਰਅੰਦਾਜ ਕੀਤਾ ਜਾ ਸਕਦਾ ਹੈ ਪਰਿਵਾਰ ਇੱਕ ਅਜਿਹੀ ਬਾਂਹ ਹੈ ਜੋ ਹਰ ਟਾਈਮ ਤੁਹਾਨੂੰ ਆਪਣੇ ਨਾਲ ਖੜ੍ਹੀ ਮਿਲੇਗੀ ਔਰ ਇੱਕ ਅਜਿਹੀ ਸਪੋਰਟ ਹੈ ਜੋ ਹਰ ਸਮੇਂ ਤੁਸੀਂ ਚਾਹੇ ਆਪਣੇ ਬਚਪਨ ਸਮੇਂ ਜਾਂ ਆਪਣੇ ਬੁਢਾਪੇ ਦੇ ਸਮੇਂ ਵਿੱਚ ਹੋਵੋਂ ਤੁਹਾਨੂੰ ਪਰਿਵਾਰ ਹਮੇਸ਼ਾਂ ਤੁਹਾਡੇ ਨਾਲ ਮਿਲੇਗਾ